ਮੇਰਾ ਜਨਮ ਪੰਜਾਬ ਵਿੱਚ ਹੋਇਆ ਹੈ ਅਤੇ ਮੈਨੂੰ ਪੰਜਾਬੀ ਆਪਣੇ ਪਰਿਵਾਰ ਵੱਲੋਂ ਵਿਰਸੇ ਵਿੱਚ ਮਿਲੀ ਹੈ ਅਤੇ ਇਸ ਤੋਂ ਬਾਅਦ ਮੇਰੀ ਸਕੂਲੀ ਸਿੱਖਿਆ ਵੀ ਪੰਜਾਬੀ ਮਾਧਿਅਮ ਵਿੱਚ ਹੋਈ ਹੈ ਪੰਜਾਬੀ ਇੱਕ ਬਹੁਤ ਹੀ ਸੁਆਦਲੀ ਅਤੇ ਮਿੱਠੀ ਬੋਲੀ ਹੈ ਅਤੇ ਇਸ ਵਿੱਚ ਗੱਲ ਕਰਨਾ ਬਹੁਤ ਹੀ ਵਧੀਆ ਲੱਗਦਾ ਹੈ ਇਸ ਨਾ ਪੰਜਾਬੀ ਨਾਲ ਗੱਲ ਕਰਨ ਨਾਲ ਮੈਂ ਆਪਣੇ ਸੱਭਿਆਚਾਰ ਅਤੇ ਸੰਸਕ੍ਰਿਤੀ ਬਾਰੇ ਵੀ ਬਹੁਤ ਕੁਝ ਸਿੱਖਿਆ ਹੈ ਅਤੇ ਮੈਨੂੰ ਆਪਣੇ ਸੱਭਿਆਚਾਰ ਅਤੇ ਸੰਸਕ੍ਰਿਤੀ ਬਾਰੇ ਵੀ ਬਹੁਤ ਹੀ ਗਿਆਨ ਪ੍ਰਾਪਤ ਹੋਇਆ ਹੈ ਮੈਨੂੰ ਆਪਣੀ ਪੰਜਾਬੀ 'ਤੇ ਮਾਣ ਹੈ